ਯੋਗ ਇੱਕ ਬਹੁਤ ਹੀ ਮਹੱਤਵਪੂਰਨ ਕਿਰਿਆ ਹੈ ਭਾਰਤ ਵਿੱਚ ਬਹੁਤ ਸਾਰੇ ਪ੍ਰਸਿੱਧ ਯੋਗ ਗੁਰੂ ਹਨ ਜਿਵੇਂ ਕਿ ਮਹਿ ਮਹਾਂਰਿਸ਼ੀ ਮਹੇਸ਼ ਯੋਗੀ ਸਵਾਮੀ ਸ਼ਿਵਾਨੰਦ ਬਾਬਾ ਰਾਮਦੇਵ ਇਹ ਸਭ ਯੋਗੀ ਸਾਨੂੰ ਯੋਗ ਕਰਨ ਲਈ ਪ੍ਰੇਰਿਤ ਕਰਦੇ ਹਨ ਤਾਂ ਜੋ ਅਸੀਂ ਸਰੀਰਕ ਤੌਰ 'ਤੇ ਫਿੱਟ ਅਤੇ ਕੁਸ਼ਲ ਰਹਿ ਸਕੀਏ ਇਸ ਦੇ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਾਂ